ਭੰਗੜੇ ਦੇ ਸਟੈਪ ਜਿਹੜੇ ਹੁੰਦੇ ਸਨ ਆਮ ਜੋ ਜੀ ਬਹੁਤ ਹੀ ਜੋਸ਼ੀਲੇ ਅਤੇ ਬਹੁਤ ਹੀ ਔਂਹ ਭਰੇ ਹੁੰਦੇ ਸਨ ਜਿਹਦੇ ਨਾਲ ਕਿ ਉਹਨਾਂ ਦਾ ਜਿੱਤਣ ਦੇ ਜਿਹੜੇ ਚਾਂਸ ਉਹ ਵਧ ਜਾਂਦੇ ਸਨ ਭੰਗੜੇ ਦੇ ਸਟੈਪ ਜਿਹੜੇ ਹੁੰਦੇ ਸਨ ਕੁੱਝ ਜਿਹੜੇ ਹੁੰਦੇ ਸਨ ਕਿ ਇੱਕ ਲੱਤ 'ਤੇ ਭੰਗੜੇ ਪਾਉਂਦੇ ਸਨ ਅਤੇ ਜਿਹਦੇ ਨਾਲ ਇੱਕੋ ਜਿਹੜੇ ਹੁੰਦੇ ਸਨ ਕਿ ਤਾੜੀ ਮਾਰ ਕੇ ਗਿੱਧਾ ਆਦਿ ਦੇ ਭੰਗੜੇ ਪਾਉਂਦੇ ਸਨ ਜਿਹਦੇ ਨਾਲ ਕਿਆ ਕੇ ਉਹਨਾਂ ਦੇ ਮਤਲਬ ਜੇਕਰ ਉਹ ਕਿਸੇ ਕੰਪਟੀਸ਼ਨ ਵਿੱਚ ਭਾਗ ਲੈਂਦੇ ਸਨ ਹਿੱਸਾ ਲੈਂਦੇ ਸਨ ਅਤੇ ਉਹਨਾਂ ਦਾ ਜਿਹੜਾ ਮਤਲਬ ਜਿੱਤਣ ਦੇ ਜਿਹੜੇ ਚਾਂਸ ਵਧ ਜਾਂਦੇ ਸਨ ਜਿਵੇਂ ਕਿਸੇ ਦੀ ਮੈਰਿਜ ਹੋਵੇ ਜਾਂ ਕੋਈ ਵਿਆਹ ਸ਼ਾਦੀ ਜਾਂ ਕਿਤੇ ਲੋਹੜੀ ਆਦਿ ਦੀ ਹੋਵੇ ਤਾਂ ਉਹਦੇ ਵਿੱਚ ਵੀ ਲੋਕ ਬਹੁਤ ਹੀ ਜੋਸ਼ੀਲੇ ਦੇ ਪ੍ਰਭਾਵ ਦੇ ਨਾਲ ਭੰਗੜਾ ਪਾਉਂਦੇ ਸਨ ਜਿਹਦੇ ਨਾਲ ਕਿ ਉਹਨਾਂ ਦੇ ਮਤਲਬ ਇਹ ਕਿਸੇ ਦੇ ਉੱਤੇ ਬਹੁਤ ਹੀ ਵਧੀਆ ਪ੍ਰਭਾਵ ਪੈਂਦਾ ਹੈ ਜਿਵੇਂ ਉਹਨਾਂ ਦਾ ਜਿਹੜਾ ਭੰਗੜਾ ਕਰਨ ਦਾ ਆ ਤਰੀਕਾ ਹੁੰਦਾ ਹੈ ਬਹੁਤ ਹੀ ਵਧੀਆ ਹੁੰਦਾ ਹੈ ਜਿਹਦੇ ਨਾਲ ਭੰਗੜੇ ਦੇ ਵਿੱਚ ਜਿਹੜੇ ਆ ਕਈ ਇਹੋ ਜਿਹੇ ਸਟੈਪ ਹੁੰਦੇ ਸਨ ਜਿਵੇਂ ਕਿ ਉਹ ਛਾਲ ਮਾਰ ਕੇ ਸਟੈਪ ਕੀਤੇ ਜਾਂਦੇ ਸਨ ਜਿਵੇਂ ਕਿ ਇੱਕ ਝੋਲੀ ਗਿੱਧਾ ਝੋਲੀ ਹੁੰਦਾ ਹੈ ਉਹਦੇ ਵਿੱਚ ਵੀ ਬਹੁਤ ਹੀ ਵਧੀਆ ਤਰੀਕੇ ਦਾ ਸਟੈਪ ਕੀਤਾ ਜਾਂਦਾ ਹੈ ਆਦਿ ਬਹੁਤ ਸਾਰੇ ਪੰਜਾਬੀ ਗੀਤਾਂ ਦੇ ਉੱਤੇ ਇੱਕ ਭੰਗੜਾ ਬਹੁਤ ਵਧੀਆ ਪਾਇਆ ਜਾਂਦਾ ਜ਼ੋਰਾਂ ਸ਼ੋਰਾਂ ਨਾਲ ਪਾਇਆ ਜਾਂਦਾ ਜਸ਼ਨ ਮਨਾਇਆ ਜਾਂਦਾ ਅਤੇ ਇਹਦੇ ਵਿੱਚ ਜਿਹੜੇ ਆ ਬਹੁਤ ਹੀ ਵਧੀਆ ਆਪਣਾ ਯੋਗਦਾਨ ਪਾਉਂਦੇ ਸਨ ਬਹੁਤ ਸਾਰੀਆਂ ਖੁਸ਼ੀਆਂ ਅਤੇ ਉਹ ਇਹਦੇ ਨਾਲ ਜਿਹੜੇ ਕਿ ਖੁਸ਼ ਨੇ ਵਿਆਹ ਸ਼ਾਦੀ ਆਦਿ ਦੇ ਵਿੱਚ ਜਿਹੜੀ ਖੁਸ਼ੀ ਜ਼ਿਆਦਾ ਵਧ ਜਾਂਦੀ ਹੈ ਭੰਗੜੇ ਦੇ ਨਾਲ ਵਧੀਆ ਮਤਲਬ ਲੋਕ ਆਪਣੇ ਆਪ ਪ੍ਰਭਾਵਿਤ ਕਰਦੇ ਸਨ ਆਪਦੀ ਖੁਸ਼ੀ ਜ਼ਾਹਿਰ ਕਰਦੇ ਸਨ ਨੱਚ ਟੱਪ ਕੇ ਆਪਦੀ ਮਤਲਬ ਖੁਸ਼ੀ ਨੂੰ ਵਧੀਆ ਜ਼ਾਹਿਰ ਕਰਦੇ ਸਨ ਕਿ ਇੱਕ ਮਤਲਬ ਆਪਣੇ ਫੈਮਲੀ ਮੈਂਬਰ ਨਾਲ ਵਧੀਆ ਸਮਾਂ ਬਤੀਤ ਕਰਦੇ ਸਨ ਇਹਨੂੰ ਭੰਗੜੇ ਦੇ ਸਟੈਪ ਜਿਹੜੇ ਹੁੰਦੇ ਸਨ ਉਹ ਇੱਕ ਦੂਜੇ ਨੂੰ ਵਧੀਆ ਰਲ ਕੇ ਕਰਦੇ ਸਨ